ਚਾਰ ਜਨਵਰੀ ਉੱਨੀ ਸੌ ਪਚਾਨਵੇਂ ਪੰਦਰਾਂ ਫਰਵਰੀ ਦੋ ਹਜ਼ਾਰ ਉੱਨੀ ਚਾਰ ਦਸੰਬਰ ਦੋ ਹਜ਼ਾਰ ਤੇਈ ਪੰਜ ਮਾਰਚ ਦੋ ਹਜ਼ਾਰ ਵੀਹ ਛੇ ਜਨਵਰੀ ਦੋ ਹਜ਼ਾਰ ਇੱਕੀ